ਮੈਂ ਆਪਣੇ ਬਾਗ ਜਾਂ ਵਿਹੜੇ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਬਹਤੁ ਕੁਝ ਮਤਲਬ ਕਿ ਬੂਟੇ ਲਗਾਏ ਹੋਏ ਹਨ ਪੇੜ ਲਗਾਏ ਹੋਏ ਹਨ ਜਿਵੇਂ ਕਿ ਅੰਬ ਪਿੱਪਲ ਨਿੰਮ ਅਮਰੂਦ ਆਦਿ ਬੂਟੇ ਲੱਗੇ ਹੋਏ ਨੇ ਜਿਨ੍ਹਾਂ ਵਿੱਚ ਪੰਛੀਆਂ ਦੇ ਘੋਸਲੇ ਅਤੇ ਹੋਰ ਮੈਂ ਆਪਣੇ ਵੱਲੋਂ ਵੀ ਕੁਝ ਕੁ ਘੋਸਲੇ ਬਜ਼ਾਰ ਤੋਂ ਮੁੱਲ ਲੈ ਕੇ ਲਗਾਏ ਹੋਏ ਨੇ ਜਿਵੇਂ ਕਿ ਹੱਟ ਜੀ ਹੱਟ ਬਣਾ ਕੇ ਉਸ ਦੇ ਵਿੱਚ ਕੁਝ ਪੰਛੀ ਰਹਿੰਦੇ ਨੇ ਇੱਦਾਂ ਹੀ ਗੱਲ ਕਰੀਏ ਤਾਂ ਕੋਇਲ ਦੀ ਕੋਇਲ ਮੈਨੂੰ ਸਵੇਰੇ ਸਵੇਰੇ ਆਪਣੀ ਮਿੱਠੀ ਅਵਾਜ਼ ਨਾਲ ਉਠਾਉਂਦੀ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਕੋਇਲ ਆਪਣੀ ਸਵੇਰੇ ਸਵੇਰੇ ਚਾਰ ਵਜੇ ਅਵਾਜ਼ ਦਿੰਦੀ ਹੈ ਤਾਂ ਇੱਦਾਂ ਹੀ ਗੱਲ ਕਰੀਏ ਪੰਛੀਆਂ ਦੇ ਅਨਾਜ ਜਾਂ ਪਾਣੀ ਦੀ ਗੱਲ ਕਰੀਏ ਤਾਂ ਮੈਂ ਰ ਪੰਛੀਆਂ ਨੂੰ ਰੋਜ਼ ਸਵੇਰੇ ਤੇ ਸ਼ਾਮੀ ਦਾਣਾ ਪਾਉਂਦਾ ਹੈ ਅਤੇ ਪਾਣੀ ਲਈ ਅਲੱਗ ਤੋਂ ਉਨ੍ਹਾਂ ਲਈ ਇੱਕ ਚਵੱਚਾ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨਾਲ ਖੇਡਦਾ ਹਾਂ ਅਤੇ ਮੇਰੇ ਆ ਕੇ ਮੋਢੇ ਤੇ ਬੈਠ ਜਾਂਦੇ ਨੇ ਅਤੇ ਪਾਣੀ ਵਿੱਚ ਕੁਝ ਕੇ ਪੰਛੀ ਤਾਂ ਮਤਲਬ ਮੇਰੇ ਮੁਹਰੇ ਨਹਾਉਂਦੇ ਵੀ ਨੇ